ਮਾਨਸਾ ਜ਼ਿਲ੍ਹਾ ਮਾਲਵੇ ਦਾ ਪ੍ਰਸਿੱਧ ਮਲਵਈਆਂ ਦਾ ਜ਼ਿਲ੍ਹਾ ਹੈ ਇੱਥੇ ਜੋ ਕਿ ਬਹੁਤ ਹੀ ਠੇਠ ਪੰਜਾਬੀ ਹਾਲੇ ਵੀ ਵੇਖਣ ਨੂੰ ਮਿਲਦੀ ਹੈ ਮੰਨ ਲਓ ਜਿਵੇਂ ਪੁਰਾਣੇ ਸਮਿਆਂ ਵਿੱਚ ਬਜ਼ੁਰਗ ਸੀ ਉਹ ਅੱਜ ਵੀ ਮਾਨਸਾ ਤੁਹਾਨੂੰ ਬਜ਼ੁਰਗ ਉਸੇ ਤਰ੍ਹਾਂ ਚਾਦਰਾ ਬੰਨ੍ਹਿਆ ਹੱਥ 'ਚ ਖੂੰਡਾ ਬਜ਼ੁਰਗਾਂ ਦੇ ਆਪਸ ਮੇਂ ਭਾਈਚਾਰਾ ਇੱਕ ਦੂਜੇ ਨੂੰ ਵਧੀਆ ਮਿੱਠਤ ਬੋਲੀ ਮਾਲਵੇ ਨਾਲ ਬੁਲਾਉਣਾ ਮਲਵਈ ਬੋਲੀ 'ਚ ਮਿੱਠਤ ਬਹੁਤ ਹੈ ਇਹ ਵਧੀਆ ਆਪਸ ਮੇਂ ਇੱਕ ਦੂਜੇ ਨੂੰ ਵਧੀਆ ਮਿਲਵਾਉਂਦੇ ਹਨ ਅਤੇ ਜੋ ਕਿ ਸ਼ਾਨ ਸਾਡੀ ਮਾਨਸਾ ਦੀ ਜਿਵੇਂ ਪਹਿਲਾਂ ਵਾਲੇ ਸਮੇਂ ਵਿੱਚ ਘਰਾਂ ਵਿੱਚ ਮੰਜੇ ਪੀੜੀਆਂ ਚੁੱਲ੍ਹੇ 'ਤੇ ਰੋਟੀ ਬਣਾਉਣੀ ਸਰ੍ਹੋਂ ਦਾ ਸਾਗ ਘਰ ਦੀ ਲੱਸੀ ਘਿਓ ਉਹ ਅੱਜ ਕੱਲ੍ਹ ਵੀ ਇੱਥੇ ਮਾਨਸਾ ਜ਼ਿਲ੍ਹੇ 'ਚ ਦੇਖਣ ਨੂੰ ਮਿਲਦਾ ਜੋ ਕਿ ਬਹੁਤ ਹੀ ਵਧੀਆ ਇੱਕ ਚੀਜ਼ ਉਪਰਾਲਾ ਹੈਗਾ ਲੋਕ ਸਾਡੇ ਅੱਜ ਵੀ ਇਸ ਚੀਜ਼ ਨੂੰ ਪਹਿਲ ਦਿੰਦੇ ਹਨ ਅਜੋਕੇ ਸਮੇਂ ਵਿੱਚ ਮਸ਼ੀਨਰੀ ਯੁੱਗ ਹੈ ਪਰ ਫਿਰ ਵੀ ਲੋਕ ਇਸ ਚੀਜ਼ ਨੂੰ ਘੱਟ ਯੂਜ਼ ਕਰਦੇ ਹਨ ਮੰਨ ਲਓ ਜਿਵੇਂ ਬਲਦਾਂ ਨਾਲ ਖੇਤੀ ਕਰਨੀ ਅੱਜ ਕੱਲ੍ਹ ਵੀ ਬਹੁਤ ਘਰਾਂ ਵਿੱਚ ਬਲਦ ਰੇੜੀਆਂ ਮਿਲ ਜਾਣਗੀਆਂ ਤੁਹਾਨੂੰ ਪਸ਼ੂ ਹਰੇਕ ਘਰ ਵਿੱਚ ਪਸ਼ੂ ਮਿਲੂਗਾ ਘਰ ਦਾ ਦਹੀਂ ਲੱਸੀ ਹੁੰਦਾ ਅਤੇ ਵਿਆਹਾਂ ਸ਼ਾਦੀਆਂ ਵਿੱਚ ਵੀ ਲੋਕ ਕੈਂਠੇ ਫ਼ੁਲਕਾਰੀਆਂ ਲੈਣੀਆਂ ਗਿੱਦਾ ਪਾਉਣਾ ਇਹ ਚੀਜ਼ਾਂ ਨੂੰ ਮਹੱਤਤਾ ਦਿੰਦੇ ਹਨ ਲੋਕ ਹੁਣ ਵੀ ਮਾਨਸਾ ਜ਼ਿਲ੍ਹੇ ਵਿੱਚ ਹੱਥਾਂ ਵਿੱਚ ਨਾਲ ਦਰੀਆਂ ਬੁਣਦੇ ਨੇ ਚਰਖੇ ਡਾਉਂਦੇ ਨੇ ਜੋ ਕਿ ਬਹੁਤ ਹੀ ਪੰਜਾਬ ਨੂੰ ਸੱਭਿਆਚਾਰ ਨੂੰ ਇੱਕ ਸਾਂਭਣ ਵਾਲੀ ਚੀਜ਼ ਹੈ ਮਾਨਸਾ ਜ਼ਿਲ੍ਹੇ ਨੂੰ ਲੋਕ ਇਸ ਕਰਕੇ ਲਾਇਕ ਕਰਦੇ ਹਨ ਕਿਉਂਕਿ ਇੱਥੋਂ ਦੇ ਲੋਕ ਬਹੁਤ ਹੀ ਵਧੀਆ ਪੰਜਾਬੀ ਵਿੱਚ ਮਲਵਈ ਵਿੱਚ ਬੋਲਦੇ ਹਨ ਜੋ ਕਿ ਇੱਕ ਹੀ ਬਹੁਤ ਵਧੀਆ ਭਾਸ਼ਾ ਹੈ ਚੁੱਲ੍ਹੇ 'ਤੇ ਰੋਟੀ ਪਕਾਉਣੀ ਇਹ ਇੱਕ ਪੁਰਾਣਾ ਰਿਵਾਜ਼ ਹੈ ਅੱਜ ਕੱਲ੍ਹ ਲੋਕ ਸਿਲਿੰਡਰਾਂ 'ਤੇ ਗੈਸਾਂ 'ਤੇ ਹੋਏ ਪਏ ਨੇ ਪਰ ਫਿਰ ਵੀ ਲੋਕ ਸਾਡੇ ਮਾਨਸਾ 'ਚ ਬਹੁਤ ਹੀ ਲੋਕ ਚੁੱਲ੍ਹੇ 'ਤੇ ਰੋਟੀ ਬਣਾਉਂਦੇ ਹਨ ਇਕੱਠੇ ਬੈਠ ਕੇ ਰੋਟੀ ਜਿਵੇਂ ਪੁਰਾਣੇ ਜ਼ਮਾਨੇ 'ਚ ਬਹਿ ਕੇ ਰੋਟੀ ਖਾਂਦੇ ਸੀ ਇਸ ਤਰ੍ਹਾਂ ਹੀ ਲੋਕ ਬਹਿ ਕੇ ਰੋਟੀ ਖਾਂਦੇ ਨੇ ਸਰ੍ਹੋਂ ਦਾ ਸਾਗ ਬਣਾਉਂਦੇ ਆ ਘਰ ਦੀ ਖੇਤੀ ਹੈ ਕਣਕ ਘਰ ਦੀ ਆ ਸਭ ਕੁਛ ਆਪਣੇ ਪਿੰਡਾਂ ਵਾਲਾ ਮਾਹੌਲ ਹੈ ਜੋ ਕਿ ਬਹੁਤ ਹੀ ਵਧੀਆ ਹੈ ਧੰਨਵਾਦ